ਹਾਂਜੀ ਹੁਣ ਤੱਕ ਅਸੀਂ ਕਢਾਈਆਂ ਦੇ ਕਾਫ਼ੀ ਡਿਜ਼ਾਇਨ ਕੱਢ ਚੁੱਕੇ ਹਾਂ ਜਿਵੇਂ ਪਹਿਲਾਂ ਅੱਜ ਕੱਲ੍ਹ ਤਾਂ ਚਲੋ ਜ਼ਿਆਦਾ ਨਹੀਂ ਅੱਜ ਕੱਲ੍ਹ ਤਾਂ ਮਸ਼ੀਨਾਂ ਰਾਹੀਂ ਹੁੰਦੀ ਹੈ ਪਹਿਲਾਂ ਜਦੋਂ ਸਾਡੇ ਵੇਲਿਆਂ ਵੇਲੇ ਕੀ ਸੀਗਾ ਅਸੀਂ ਹੱਥ ਨਾਲ ਕਢਾਈ ਕਰਦੇ ਸੀ ਜਿਵੇਂ ਕਾਫ਼ੀ ਤਰ੍ਹਾਂ ਦੇ ਇੱਕੀ ਤਰ੍ਹਾਂ ਦੇ ਟਾਂਕਿਆਂ ਦਾ ਬਾਰੇ ਦੱਸਿਆ ਜਾਂਦਾ ਸੀਗਾ ਜਦੋਂ ਅਸੀਂ ਸਿੱਖਦੇ ਸੀ ਜਿਵੇਂ ਸਿੰਧੀ ਟਾਂਕਾ ਹੋ ਗਿਆ ਕੋਈ ਗੰਢ ਤੋਪਾ ਹੋ ਗਿਆ ਸੰਗਲ ਤੋਪਾ ਹੋ ਗਿਆ ਅਤੇ ਮੱਛੀ ਟਾਂਕਾ ਹੋ ਗਿਆ ਇਸ ਤਰ੍ਹਾਂ ਦੇ ਫੁਲਕਾਰੀ ਇਸ ਤਰ੍ਹਾਂ ਦੇ ਕਾਫ਼ੀ ਤਰ੍ਹਾਂ ਦੇ ਡਿਜ਼ਾਇਨ ਅਸੀਂ ਜਿਹੜੇ ਕਿ ਕੱਢਦੇ ਹੁੰਦੇ ਸੀ ਜਿਹੜੇ ਕਿ ਵਧੀਆ ਲੱਗਦੇ ਸੀ ਅਸੀਂ ਸਾਰੇ ਜਣਿਆਂ ਇਕੱਠੇ ਹੋ ਕੇ ਬੈਠਣਾ ਤਾਂ ਸਾਰਿਆਂ ਨੇ ਹੱਥ ਨਾਲ ਕੱਢਣੇ ਪੂਰਾ ਪਹਿਲਾਂ ਛਪਵਾ ਕੇ ਲਿਆਉਣਾ ਉਹਨਾਂ ਨੂੰ ਫਿਰ ਉਹਦੇ ਉੱਤੇ ਵਰਕ ਕਰਨਾ ਅਤੇ ਸੂਟ ਵਗੈਰਾ ਸ਼ਰਟ ਵਗੈਰਾ ਜੋ ਵੀ ਅਸੀਂ ਕਰਦੇ ਹੁੰਦੇ ਸੀ ਅਤੇ ਸਭ ਤੋਂ ਜ਼ਿਆਦਾ ਤਾਂ ਸਿੰਧੀ ਟਾਂਕਾ ਜਿਹੜਾ ਹੁੰਦਾ ਸੀ ਉਹਦੇ ਜ਼ਿਆਦਾ ਹੁੰਦਾ ਸੀ ਹੁਣ ਵੀ ਥੋੜ੍ਹਾ ਥੋੜ੍ਹਾ ਜਿਵੇਂ ਟਰੈਂਡ ਆ ਰਿਹਾ ਉਸ ਟਾਂਕੇ ਦਾ ਤਾਂ ਬਾਕੀ ਜਿਵੇਂ ਚਾਦਰਾਂ ਵਗੈਰਾ ਕੱਢਣੀਆਂ ਆਪਣੇ ਤਿਆਰ ਕਰਨੇ ਕੁੜੀਆਂ ਨੂੰ ਦਾਜ 'ਚ ਦੇਣ ਲਈ ਤਾਂ ਪੱਖੀਆ ਵਗੈਰਾ ਬਣਾਉਣੀਆਂ ਇਹ ਸਾਰਾ ਕੁਛ ਹੀ ਹੁੰਦਾ ਸੀ ਹੁਣ ਤਾਂ ਚਲੋ ਸਾਰਾ ਕੁਛ ਮਸ਼ੀਨੀ ਹੋ ਗਿਆ ਅੱਜ ਕੱਲ੍ਹ ਤਾਂ ਚਲੋ ਸੂਟ ਲਾਏ ਮਸ਼ੀਨਾਂ 'ਤੇ ਤਾਂ ਉਹਨਾਂ ਨੂੰ ਫੀਡ ਕੀਤਾ ਡਿਜ਼ਾਈਨ ਨੂੰ ਤਾਂ ਚਲੋ ਵੀ ਤਿਆਰ ਹੋ ਜਾਂਦਾ ਸੂਟ ਤਾਂ ਅੱਜ ਤੱਕ ਦਾ ਜਿਹੜਾ ਸਭ ਤੋਂ ਵਧੀਆ ਡਿਜ਼ਾਇਨ ਹੈ ਸਭ ਤੋਂ ਜ਼ਿਆਦਾ ਤਾਂ ਮੋਰਨੀ ਵਾਲਾ ਡਿਜ਼ਾਈਨ ਹੀ ਚੱਲਦਾ ਹੁੰਦਾ ਸੀ ਤਾਂ ਹੁਣ ਵੀ ਅੱਜ ਕੱਲ੍ਹ ਜ਼ਿਆਦਾ ਮੋਰਨੀ ਵਾਲਾ ਡਿਜ਼ਾਇਨ ਚੱਲਦਾ ਤਾਂ ਜਿਹੜੇ ਔਖੇ ਔਖੇ ਡਿਜ਼ਾਈਨ ਡਿਜ਼ਾਇਨ ਹੁੰਦੇ ਸੀ ਉਹ ਅਸੀਂ ਆਪਣਾ ਵੀ ਮਤਲਬ ਕਰ ਤਾਂ ਲਈ ਦੇ ਸੀ ਕਿਉਂਕਿ ਜਦੋਂ ਇੱਕ ਵਾਰ ਸਿੱਖਦੇ ਸੀ ਕਸ਼ਮੀਰੀ ਟਾਂਕਾ ਸਾਰਿਆਂ ਨਾਲੋਂ ਆਜ਼ਿਦਾ ਔਖਾ ਲੱਗਦਾ ਸੀ ਤਾਂ ਪਰ ਕਰ ਤਾਂ ਲਈ ਦਾ ਸੀ ਫਿਰ ਸ਼ੋਲ ਵਗੈਰਾ ਕੱਢੇ ਜਾਂਦੇ ਸੀ ਉਹਦੇ ਨਾਲ ਸੂਟਾਂ 'ਤੇ ਵੀ ਕੀਤਾ ਜਾਂਦਾ ਸੀ ਦੁਪੱਟਿਆਂ 'ਤੇ ਵੀ ਕੀਤਾ ਜਾਂਦਾ ਸੀ ਤਾਂ ਵਧੀਆ ਲੱਗਦਾ ਸੀ ਸਾਰਾ ਜਦੋਂ ਇਕੱਠੇ ਹੋ ਕੇ ਕਰਦੇ ਸੀਗੇ ਹੁਣ ਚਲੋ ਐਂ ਹਾਂ ਵੀ ਥੋੜ੍ਹਾ ਟਰੈਂਡ ਘੱਟ ਗਿਆ ਤਾਂ ਹੁਣ ਇੰਨਾ ਨਹੀਂ ਕਰੀਦਾ ਫਿਰ ਵੀ ਅੱਜ ਕੱਲ੍ਹ ਵੀ ਸੂਟਾਂ ਦਾ ਕਾਫ਼ੀ ਹੈਂਡ ਵਰਕ ਵਗੈਰਾ ਦਾ ਡਿਜ਼ਾਇਨ ਕਰ ਲਈ ਦੇ ਹੈ ਤਾਂ ਵਧੀਆ ਲੱਗਦੇ ਆ ਸੋ ਥੈਂਕ ਯੂ